ਹਾਂਜੀ ਸਾਡੇ ਪਿੰਡ ਤੁੰਗਵਾਲੇ ਵਿਖੇ ਇੱਕ ਮੱਖੀ ਫਾਰਮ ਖੋਲ੍ਹਿਆ ਸੀ ਜੋ ਕਿ ਉਹਨਾਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਹੈ ਮੱਖੀ ਫਾਰਮ ਉਹਨਾਂ ਨੇ ਬੋਕਸ ਲਿਆ ਕੇ ਲਗਾਏ ਸੀ ਅਤੇ ਉਹਨਾਂ ਨੂੰ ਜੋ ਕਿ ਕਾਫੀ ਆਮਦਨ ਬਹੁਤ ਜ਼ਿਆਦਾ ਹੋਈ ਹੈ ਕਿਉਂਕਿ ਸ਼ਹਿਦ ਵਗੈਰਾ ਦਾ ਆਮ ਜ਼ਰੂਰਤ ਪੈਂਦੀ ਰਹਿੰਦੀ ਹੈ ਪਿੰਡਾਂ ਵਿੱਚ ਕਿਉਂਕਿ ਪਹਿਲਾਂ ਪੁਰਾਣੇ ਲੋਕ ਸੀ ਜੋ ਸ਼ਹਿਦ ਵਗੈਰਾ ਬਹੁਤ ਜ਼ਿਆਦਾ ਮਤਲਬ ਖਰੀਦਦੇ ਸੀ ਅਤੇ ਅੱਜ ਕੱਲ ਜੋ ਹੈ ਕਿ ਸੇਤ ਸ਼ਹਿਦ ਸਾਨੂੰ ਬਹੁਤ ਘੱਟ ਮਿਲਦਾ ਹੈ ਅਤੇ ਇਸ ਲਈ ਸਾਡੇ ਪਿੰਡ ਇੱਕ ਮਤਲਬ ਤੁੰਗਵਾਲੇ ਵਿਖੇ ਉਹਨਾਂ ਨੇ ਮੱਖੀ ਫਾਰਮ ਖੋਲ੍ਹਿਆ ਸੀ ਅਤੇ ਅੱਜ ਉਹ ਲੱਖਾਂ ਕਰੋੜਾਂ ਵਿੱਚ ਇੰਨੀ ਜ਼ਿਆਦਾ ਆਮਦਨ ਹੋ ਰਹੀ ਹੈ ਕਿ ਉਹਨਾਂ ਨੇ ਬਹੁਤ ਵੱਡੀ ਕਮਾਈ ਕੀਤੀ ਹੈ ਉਹਨਾਂ ਨੇ ਅਲੱਗ ਅਲੱਗ ਜਗ੍ਹਾ 'ਤੇ ਆਪਣੇ ਮੱਖੀ ਫਾਰਮ ਹੈ ਜੋ ਖੋਲ੍ਹ ਰੱਖੇ ਹਨ ਅਤੇ ਇਸ ਟਾਇਮ ਉਹਨਾਂ ਕੋਲ ਬਹੁਤ ਵੱਡੀ ਹਵੇਲੀ ਹੈ ਅਤੇ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਹਨ ਧੰਨਵਾਦ ਜੀ